ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਬੜੀਆਂ ਸੰਸਥਾਵਾਂ ਹਨ ਜਿਹੜੀਆਂ ਫੋਟੋਗ੍ਰਾਫੀ ਦੀ ਡਿਗਰੀ ਪ੍ਰਾਪਤ ਕਰਨ ਵਿੱਚ ਬਹੁਤ ਮਦਦ ਕਰਦੀਆਂ ਹਨ ਫੋਟੋਗ੍ਰਾਫੀ ਦੀ ਡਿਗਰੀ ਇੱਕ ਮਨੁੱਖ ਜੋ ਫੋਟੋਗ੍ਰਾਫੀ ਦੇ ਪੱਧਰ ਨੂੰ ਪਾਉਣਾ ਚਾਹੁੰਦਾ ਹੈ ਉਹਦੇ ਲਈ ਇਹ ਡਿਗਰੀ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈਗਾ ਫੋਟੋਗ੍ਰਾਫੀ ਵੀ ਬਿਨ੍ਹਾਂ ਉਹ ਦੀ ਡਿਗਰੀ ਦੇ ਬਿਲਕੁਲ ਵੀ ਹਾਸਲ ਨਹੀਂ ਹੁੰਦੀ ਹੈ ਜੇ ਤੁਹਾਡਾ ਰਾਸ਼ਟਰੀ ਪੱਧਰ 'ਤੇ ਸੰਸਥਾਵਾਂ ਦੀ ਫੋਟੋਗ੍ਰਾਫੀ ਦੀ ਡਿਗਰੀ ਪ੍ਰਾਪਤ ਕਰਨ ਦਾ ਮਨ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਜੇ ਤੁਹਾਡਾ ਅੰਤਰਰਾਸ਼ਟਰੀ ਪੱਧਰ ਦੀ ਸੰਸਥਾਵਾਂ 'ਤੇ ਫੋਟੋਗ੍ਰਾਫੀ ਕਰਨ ਦਾ ਮਨ ਹੈ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਰਾਸ਼ਟਰ ਅਤੇ ਅੰਤਰਰਾਸ਼ਟਰ ਦੋਵੇਂ ਹੀ ਪੱਧਰ ਬਹੁਤ ਸਾਰੀਆਂ ਸੰਸਥਾਵਾਂ ਪ੍ਰਦਾਨ ਕਰਦੇ ਹਨ ਜਿਹੜੀਆਂ ਤੁਹਾਨੂੰ ਫੋਟੋਗ੍ਰਾਫੀ ਦੀ ਡਿਗਰੀ ਪ੍ਰਾਪਤ ਕਰਨ ਵਿੱਚ ਬਹੁਤ ਮਦਦ ਕਰਨ ਗੀਆਂ ਫੋਟੋਗ੍ਰਾਫੀ ਦੀ ਡਿਗਰੀ ਬਹੁਤ ਇੱਕ ਜ਼ਰੂਰੀ ਹੈਗੀ ਹੈ ਜੇ ਤੁਸੀਂ ਫੋਟੋਗ੍ਰਾਫੀ ਨੂੰ ਆਪਣੇ ਕੰਮ ਵਿੱਚ ਵਰਤੋਂ ਲਿਆਉਣਾ ਚਾਹੁੰਦੇ ਹੋ ਫੋਟੋਗ੍ਰਾਫੀ ਬਹੁਤ ਅਹਿਮ ਰੋਲ ਅਦਾ ਨਿਭਾਉਂਦੀ ਹੈ ਜਦੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਕੋਈ ਵੀ ਇੱਦਾਂ ਦਾ ਕੰਮ ਕਰਨਾ ਹੋਵੇ ਫੋਟੋਗ੍ਰਾਫੀ 'ਤੇ ਉਹ ਦੀ ਡਿਗਰੀ ਦੋਨੋਂ ਹੀ ਅਹਿਮ ਰੋਲ ਅਦਾ ਕਰਦੇ ਹਨ ਫੋਟੋਗ੍ਰਾਫੀ ਇਹ ਚਾਹੁੰਦੀ ਹੈ ਕਿ ਉਹ ਵਧੀਆ ਮਨੁੱਖ ਨੂੰ ਦਿਖਾਵੇ ਧੰਨਵਾਦ